ਸਤਿ ਸ਼੍ਰੀ ਅਕਾਲ ਜੀ ਰਾਜ ਦੀ ਅਮੀਰ ਸੱਭਿਆਚਾਰਕ ਵਿਭਿੰਨਤਾ ਦਾ ਅਨੁਭਵ ਕਰਨ ਦੇ ਲਈ ਜੇਕਰ ਸੈਲਾਨੀ ਦਿਲਚਸਪੀ ਰੱਖਦੇ ਹਨ ਤਾਂ ਉਹਨਾਂ ਦੇ ਲਈ ਕਾਫੀ ਵਿਕਲਪ ਮੌਜੂਦ ਹੁੰਦੇ ਹਨ ਜਿਵੇਂ ਕਿ ਰਾਜ ਦੇ ਵਿੱਚ ਪਿੰਡਾਂ ਨੇ ਕਿਵੇਂ ਤਰੱਕੀ ਕੀਤੀ ਹੈ ਪਿੰਡਾਂ ਦੀ ਭਾਈਚਾਰਕ ਸਾਂਝ ਕਿਹੜੀ ਹੈ ਪਿੰਡਾਂ ਨੇ ਕਿਹੜੀ ਨਵੀਂ ਤਕਨੀਕ ਅਪਣਾਈ ਹੈ ਰਾਜ ਦੇ ਵਿੱਚ ਕਿਹੜੀ ਕਿਹੜੀਆਂ ਇਤਿਹਾਸਿਕ ਥਾਵਾਂ ਹਨ ਕਿਹੜੇ ਮੰਦਰ ਅਤੇ ਗੁਰਦੁਆਰਾ ਸਾਹਿਬ ਹਨ ਇਹਨਾਂ ਦਾ ਦੌਰਾ ਵੀ ਕੀਤਾ ਜਾ ਸਕਦਾ ਹੈ ਰਾਜ ਦੇ ਸੱਭਿਆਚਾਰ ਨੂੰ ਜਾਨਣ ਦੇ ਲਈ ਇੱਥੋਂ ਦੇ ਬੋਲੀ ਲੋਕ ਨਾਚ ਗੀਤ ਅਤੇ ਤਿਉਹਾਰਾਂ ਦੇ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਰਾਜ ਦੇ ਮੁੱਖ ਕਿੱਤੇ ਦੇ ਬਾਰੇ ਵੀ ਜਾਣਿਆ ਜਾ ਸਕਦਾ ਹੈ ਕਈ ਵਾਰ ਰਾਜ ਦੇ ਵਿੱਚ ਵਣ ਜਾਂ ਫਿਰ ਕੋਈ ਖਾਸ ਕਿਸਮ ਦੇ ਬਗੀਚੇ ਆਦਿ ਮੌਜੂਦ ਹੋਣ ਤਾਂ ਉਸਦੇ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਸਕਦੀ ਹੈ ਕਈ ਵਾਰ ਸਰਕਾਰੀ ਇਮਾਰਤਾਂ ਵੀ ਹੁੰਦੀਆਂ ਹਨ ਜਿਨ੍ਹਾਂ ਦੇ ਬਾਰੇ ਜਾਣਿਆ ਜਾ ਸਕਦਾ ਹੈ ਧੰਨਵਾਦ ਜੀ